ਇੱਕ ਵਾਰ ਸਾਡੇ ਪਿੰਡ ਵਿੱਚ ਸੱਭਿਆਚਾਰਕ ਮੇਲਾ ਲੱਗਿਆ ਹੋਇਆ ਸੀ ਮੈਨੂੰ ਵੀ ਗਾਉਣ ਦਾ ਸ਼ੌਕ ਹੈ ਅਤੇ ਮੈਂ ਗਾਉਣ ਦੇ ਬਾਰੇ ਸੋਚਿਆ ਮੈਂ ਆਪਣੇ ਪਿੰਡ ਦੇ ਪ੍ਰਧਾਨ ਨੂੰ ਕਹਿ ਕੇ ਗਾਉਣ ਦਾ ਇੱਕ ਮੌਕਾ ਲੈ ਲਿਆ ਜਦੋਂ ਮੈਂ ਸਟੇਜ 'ਤੇ ਚੜ੍ਹਿਆ ਤਾਂ ਲੋਕਾਂ ਨੂੰ ਦੇਖ ਕੇ ਮੈਨੂੰ ਡਰ ਮਹਿਸੂਸ ਹੋਇਆ ਗਾਉਣ ਦੇ ਵਿੱਚ ਮੇਰੇ ਘਬਰਾਹਟ ਜਿਹੀ ਹੋ ਗਈ ਅਤੇ ਮੈਂ ਫਿਰ ਅੱਖਾਂ ਬੰਦ ਕਰਕੇ ਆਪਣੇ ਦਿਲ ਨੂੰ ਟਾਈਟ ਕੀਤਾ ਅਤੇ ਸੋਚਿਆ ਕਿ ਮੈਂ ਵਧੀਆ ਤਰੀਕੇ ਨਾਲ ਗਾਉਣਾ ਹੈ ਅਤੇ ਮੈਂ ਅੱਖਾਂ ਬੰਦ ਕਰਕੇ ਜਦੋਂ ਗਾਉਣਾ ਸ਼ੁਰੂ ਕੀਤਾ ਆਪਣੇ ਘਰ ਦੀ ਫੀਲਿੰਗ ਵਿੱਚ ਲੈ ਕੇ ਕਿ ਮੈਂ ਘਰ ਬੈਠਾ ਆਪਣੇ ਅਰਾਮ ਨਾਲ ਗਾਣਾ ਗਾ ਰਿਹਾ ਤਾਂ ਮੈਂ ਬਹੁਤ ਵਧੀਆ ਗਾਣਾ ਗਾਇਆ ਅਤੇ ਵਧੀਆ ਗਾਣਾ ਗਾਇਆ ਲੋਕਾਂ ਨੇ ਬਹੁਤ ਤਾੜੀਆਂ ਵਜਾਈਆਂ ਅਤੇ ਮੈਨੂੰ ਵੀ ਵਧੀਆ ਲੱਗਿਆ ਉਸ ਤੋਂ ਮੈਂ ਇਹ ਚੀਜ਼ ਸਿੱਖੀ ਹੈ ਕਿ ਜਦੋਂ ਵੀ ਬੰਦੇ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਤਾਂ ਆਪਣੇ ਦ੍ਰਿੜ ਇਰਾਦੇ ਆਪਣੇ ਮਜ਼ਬੂਤ ਇਰਾਦੇ ਨਾਲ ਹੀ ਕਰਨਾ ਚਾਹੀਦਾ ਹੈ ਲੋਕਾਂ ਵੱਲ ਦੇਖਕੇ ਘਬਰਾਉਣਾ ਨਹੀਂ ਚਾਹੀਦਾ ਹੈ ਤੇ ਸਮਾ ਕਿ ਲੋਕਾਂ ਨੂੰ ਦੇਖ ਕੇ ਬੰਦੇ ਵਿੱਚ ਹੌਸਲਾ ਆਉਣਾ ਚਾਹੀਦਾ ਹੈ ਕਿ ਇਹ ਮੈਨੂੰ ਦੇਖ ਕੇ ਮੇਰੀ ਤਰੀਫ਼ ਕਰਨਗੇ